ਸੁਰੱਖਿਆ ਦਾ ਮਤਲਬ ਹੈ ਸਰੀਰ ਦੀ ਸੁਰੱਖਿਆ ਅੱਜ ਕੱਲ੍ਹ ਵ ਹਰ ਪ੍ਰਕਾਰ ਦਾ ਵਹੀਕਲ ਚਲਾਉਣ ਦੇ ਲਈ ਬਾਈਕ ਸਾਈਕਲ ਚਲਾਉਣ ਦੇ ਲਈ ਹੈਲਮੈਟ ਲਾਉਣਾ ਬਹੁਤ ਜ਼ਰੂਰੀ ਹੈ ਕੁਝ ਕੁਝ ਲੋਕ ਤਾਂ ਪੁਲਿਸ ਦੇ ਡਰ ਨਾਲ ਹੀ ਹੈਲਮੈਟ ਲਾਉਂਦੇ ਹਨ ਪਰ ਹੈਲਮੈਟ ਉਹਨਾਂ ਨੂੰ ਨਹੀਂ ਪਤਾ ਕਿ ਹੈਲਮੈਟ ਬਹੁਤ ਜ਼ਰੂਰੀ ਹੈ ਕਿਉਂਕਿ ਦਿਮਾਗ 'ਤੇ ਲੱਗੀ ਸੱਟ ਬੰਦੇ ਦੀ ਜਾਨ ਲੈ ਜਾਂਦੀ ਏ ਇਸ ਲਈ ਹੈਲਮੈਟ ਲਾਉਣਾ ਬਹੁਤ ਜ਼ਰੂਰੀ ਏ ਅਤੇ ਸਾਈਕਲ ਚਲਾਉਣ ਦੇ ਲਈ ਆਪਣੇ ਗੋਡਿਆਂ ਨੂੰ ਕਵਰ ਕਰਨਾ ਜਿਵੇਂ ਕਈ ਪ੍ਰਕਾਰ ਦੀਆਂ ਅ ਅੱਜ ਕੱਲ੍ਹ ਉਪਕਰਨ ਮਿਲਦੇ ਹਨ ਜੋ ਕਿ ਸਾਡੇ ਗੋਡਿਆਂ ਦੀ ਸੇਫਟੀ ਲਈ ਬਹੁਤ ਜ਼ਰੂਰੀ ਹੈ ਆਦਿ ਇਨ੍ਹਾਂ ਚੀਜ਼ਾਂ ਦਾ ਯੂਸ ਕਰਨਾ ਚਾਹੀਦਾ ਏ ਅਤੇ ਸਾਈਕਲ ਚਲਾਉਂਦੇ ਸਮੇਂ ਰਸਤੇ 'ਚ ਹਮੇਸ਼ਾਂ ਆਪਣੇ ਲੈਫਟ ਹੈਂਡ ਚੱਲਣਾ ਚਾਹੀਦਾ ਹੈ ਅਤੇ ਥੱਲੇ ਨਹੀਂ ਦੇਖਣਾ ਚਾਹੀਦਾ ਸਿੱਧਾ ਸਾਹਮਣੇ ਦੇਖਣਾ ਚਾਹੀਦਾ ਹੈ ਅਤੇ ਦੂਜੀ ਗੱਲ ਯਾਤਰਾ ਦੌਰਾਨ ਮੈਂ ਆਪਣੇ ਦੇ ਨਾਲ ਆਪਣੇ ਨਾਲ ਆਪਣਾ ਅਧਾਰ ਕਾਰਡ ਏ ਟੀ ਐਮ ਆਦਿ ਰੱਖਦੀ ਹਾਂ ਅੱਜ ਕੱਲ੍ਹ ਡੀ ਡੀਜੀਟਲ ਜ਼ਮਾਨੇ ਦੇ ਕਰਕੇ ਮੈਂ ਆਪਣੇ ਹੋਰ ਦਸਤਾਵੇਜ਼ ਆਪਣੇ ਫੋਨ ਦੇ ਵਿੱਚ ਹੀ ਰੱਖਦੀ ਹਾਂ ਜਿਵੇਂ ਕਿਤੇ ਲੋੜ ਪਈ ਤਾਂ ਯੂਸ ਕਰ ਸਕਦੀ ਹਾਂ ਕਿਉਂਕਿ ਸਾਰੇ ਦਸਤਾਵੇਜ਼ ਨਾਲ ਲਿਜਾਣੇ ਗੁੰਮ ਹੋ ਜਾਂਦੇ ਹਨ ਜਿਸ ਦੇ ਨਾਲ ਅੱਗੇ ਜਾ ਕੇ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ